ਮੋਹਾਲੀ ਜ਼ਿਲ੍ਹੇ ਦੇ ਵਿੱਚ ਬੈਟਰੀ ਰਿਕਸ਼ਾ ਬਹੁਤ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਜਿਨ੍ਹਾਂ ਨਾਲ ਲੋਕਲ ਜਾਣਾ ਆਉਣਾ ਅਤੇ ਨੋਨ ਪਲਿਊਸ਼ਨ ਵਹੀਕਲ ਹੈ ਉਹ ਤੋਂ ਬਾਅਦ ਬੈਟਰੀ ਵਾਲੀਆਂ ਗੱਡੀਆਂ ਬੜੀਆਂ ਬਹੁਤ ਜ਼ਿਆਦਾ ਟੈਕਸੀ ਦੇ ਵਿੱਚ ਅੱਜ ਕੱਲ੍ਹ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਲੋਕਾਂ ਨੂੰ ਬੈਟਰੀ ਵਾਲੀਆਂ ਬੱਸਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜੀਆਂ ਸ਼ੁਰੂ ਕੀਤੀਆਂ ਉਹ ਮੋਹਾਲੀ 'ਚ ਬਹੁਤ ਜ਼ਿਆਦਾ ਉਹਨਾਂ ਦੀ ਆਮਦ ਦੇਖੀ ਜਾ ਸਕਦੀ ਹੈ ਆਉਂਦੀਆਂ ਜਾਂਦੀਆਂ ਅਤੇ ਉਹ ਤੋਂ ਬਾਅਦ ਰੋਪੇ ਬਹੁਤ ਤਕੜਾ ਬਣਾਇਆ ਗਿਆ ਲੋਕ ਪੈਦਲ ਵੀ ਜਾ ਸਕਦੇ ਹੈ ਅਤੇ ਗਰੀਨਰੀ ਪੱਖੋਂ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਪੈਦਲ ਜਾਂਦੇ ਹੈ ਗਰੀ ਦਰੱਖਤਾਂ ਦੀ ਛਾਵਾਂ ਰਹਿੰਦੀ ਹੈ ਅਤੇ ਉਬਰ ਟੈਕਸੀ ਦਾ ਬਹੁਤ ਤਕੜਾ ਯੂਜ ਕੀਤਾ ਜਾਂਦਾ ਅਤੇ ਟਰੇਨਾਂ ਰੇਲਵੇ ਸਟੇਸ਼ਨ ਬਹੁਤ ਵਧੀਆ ਬਣਾਇਆ ਹੋਇਆ ਮੋਹਾਲੀ ਜ਼ਿਲ੍ਹੇ ਦੇ ਵਿੱਚ ਅਤੇ ਟਰੇਨਾਂ ਆਲਮੋਸਟ ਸਾਰੇ ਪੰਜਾਬ ਨੂੰ ਯੂਪੀ ਨੂੰ ਉੱਥੋਂ ਟ੍ਰਾਂਸਪੋਰਟੇਸ਼ਨ ਦਾ ਜਿਹੜਾ ਇੱਧਰ ਉੱਧਰ ਜਾਣ ਦਾ ਪ੍ਰਬੰਧ ਕੀਤਾ ਗਿਆ ਅੱਛਾ ਉਹ ਤੋਂ ਬਾਅਦ ਜੀ ਬ ਬੱਸਾਂ ਆਲ ਇੰਡੀਆ ਨੂੰ ਜਾਂਦੀਆਂ ਬੱਸ ਸਟੈਂਡ ਬਹੁਤ ਜ਼ਬਰਦਸਤ ਹੈ ਵਧੀਆ ਬਣਾਇਆ ਹੋਇਆ ਮੋਹਾਲੀ ਦੇ ਵਿੱਚ ਜਿਹੜਾ ਪੂਰੇ ਇੰਡੀਆ ਲੈਵਲ ਦਿੱਲੀ ਤੱਕ ਦਾ ਸਫਰ ਹੈ ਗੋਰਖਪੁਰ ਹੈ ਲਖਨਊ ਤੱਕ ਦਾ ਸਫਰ ਹੈ ਇੱਧਰ ਹਿਮਾਚਲ ਤੱਕ ਦਾ ਸਫਰ ਹੈ ਜੰਮੂ ਕੱਟੜਾ ਤੱਕ ਦਾ ਸਫਰ ਹੈ ਸ਼੍ਰੀਨਗਰ ਦਾ ਤੱਕ ਦਾ ਸਫਰ ਹੈ ਉਹ ਹੈ ਮ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਮੋਹਾਲੀ ਤੋਂ ਪ੍ਰੋਵਾਈਡ ਕਰਵਾਇਆ ਜਾਂਦਾ ਉਹ ਤੋਂ ਬਾਅਦ ਬ ਰੋਪੇ ਬੜੇ ਤਕੜੇ ਬਣਾਏ ਗਏ ਹੈ ਅਤੇ ਟੈਂਕ ਜਿਹੜੀਆਂ ਅੱਜ ਕੱਲ੍ਹ ਸੜਕਾਂ ਪਾਰ ਕਰਨ ਵਾਸਤੇ ਮ ਵਧੀਆ ਤਰੀਕੇ ਦੇ ਨਾਲ ਬਣਾਈ ਗਈਆਂ ਸਟੇਅਰਸ ਕਹਿ ਦਿੰਦੇ ਨੇ ਜਿਨ੍ਹਾਂ ਨੂੰ ਅਤੇ